ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਵਿੰਦ ਹੈਗਾ ਅਤੇ ਮੈਂ ਪਠਾਨਕੋਟ ਤੋਂ ਰਹਿਣੇ ਵਾਲਾ ਹਾਂ ਜਿਵੇਂ ਕਿ ਮੈਂ ਦੱਸਾਂ ਪੰਜਾਬ ਲੋਕ ਜਿਹੜੇ ਹੈ ਆਪਣੀ ਭਾਸ਼ਾ ਦੇ ਕਿਵੇਂ ਪਛਾਣਦੇ ਹੈਗੇ ਆ ਜਿੱਦਾਂ ਕਿ ਸਾਡੇ ਜਿਹੜੇ ਹੈ ਪੰਜਾਬ ਵਿੱਚ ਚਾਰ ਇਲਾਕੇ ਹੈਗੇ ਹੈ ਮਾਝਾ ਦੁਆਬਾ ਮਲਵਈ ਅਤੇ ਪੁਆਧਾ ਅਤੇ ਇਹ ਜਿਹੜੇ ਜਦੋਂ ਵੀ ਇਹ ਕੋਈ ਵੀ ਗੱਲ ਹੈਗੇ ਹੈ ਜਾਂ ਕੁਛ ਵੀ ਬੋਲਦੇ ਹੈਗੇ ਹੈ ਤਾਂ ਸ ਸਮਝ ਜਾਂਦੇ ਹੈ ਕਿ ਇਹ ਕਿੱਥੋਂ ਇਹ ਪੰਜਾਬੀ ਬੋਲ ਰਿਹਾ ਹੈ ਜਾਂ ਇਹ ਕਿੱਥੋਂ ਦਾ ਹੈਗਾ ਅਤੇ ਤਾਂ ਕਰਕੇ